ਚੌਦ੍ਹਾਂ ਅਪ੍ਰੈਲ ਉੱਨੀ ਸੌ ਸੱਠ ਦਸ ਜਨਵਰੀ ਉੱਨੀ ਸੌ ਅਠਾਹਠ ਦਸ ਅਗਸਤ ਉੱਨੀ ਸੌ ਉਣਾਸੀ ਪੱਚੀ ਨਵੰਬਰ ਉੱਨੀ ਸੌ ਇਕਾਸੀ ਅਤੇ ਤੀਹ ਅਪ੍ਰੈਲ ਉੱਨੀ ਦੋ ਹਜ਼ਾਰ ਵੀਹ